ਚਿੱਤਰਕਾਰੀ ਮੈਂ ਆਪਣੇ ਸਕੂਲ ਤੋਂ ਬਹੁਤ ਵਧੀਆ ਅਧਿਆਪਕ ਤੋਂ ਪ੍ਰਾਪਤ ਕੀਤੀ ਉਹਨਾਂ ਨੇ ਮੈਨੂੰ ਚਿੱਤਰਕਾਰੀ ਬਾਰੇ ਬਹੁਤ ਵਧੀਆ ਢੰਗ ਨਾਲ ਸਮਝਾਇਆ ਰੰਗਾਂ ਦੀ ਪਹਿਚਾਣ ਕਰਵਾਈ ਚਿੱਤਰਕਾਰੀ ਕਰਨ ਲਈ ਮਨ ਵਿੱਚ ਭਾਵਨਾ ਹੋਣੀ ਚਾਹੀਦੀ ਹੈ ਅਸੀਂ ਜੋ ਵੀ ਚੀਜ਼ ਸਿੱਖਣੀ ਹੈ ਉਸ ਨੂੰ ਪਹਿਲਾਂ ਆਪਣੇ ਅੰਦਰੋਂ ਸਿੱਖਣ ਦੀ ਭਾਵਨਾ ਨੂੰ ਉਜਾਗਰ ਕਰਨਾ ਚਾਹੀਦਾ ਹੈ ਚਿੱਤਰਕਾਰੀ ਲਈ ਸਭ ਤੋਂ ਪਹਿਲਾਂ ਪੇਂਟ ਦੀ ਪਹਿਚਾਣ ਹੋਣੀ ਚਾਹੀਦੀ ਹੈ ਰੰਗਾਂ ਦੀ ਪਹਿਚਾਣ ਹੋਣੀ ਚਾਹੀਦੀ ਹੈ ਸਕੂਲ ਵਿੱਚ ਸਭ ਤੋਂ ਪਹਿਲਾਂ ਬੱਚੇ ਨੂੰ ਰੰਗਾਂ ਦੀ ਪਹਿਚਾਣ ਕਰਵਾਉਣੀ ਚਾਹੀਦੀ ਹੈ ਜਿਸ ਨਾਲ ਉਸ ਨੂੰ ਚਿੱਤਰਕਾਰੀ ਕਰਨ ਲਈ ਵਧੀਆ ਰੰਗਾਂ ਦੀ ਪਹਿਚਾਣ ਹੋਵੇ ਸਕੂਲ ਵਿੱਚ ਚਿੱਤਰਕਾਰੀ ਲਈ ਅਧਿਆਪਕ ਨੂੰ ਵੀ ਚਿੱਤਰਕਾਰੀ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਜਿਸ ਨਾਲ ਉਹ ਬੱਚੇ ਨੂੰ ਵਧੀਆ ਤਰੀਕੇ ਨਾਲ ਸਮਝਾ ਸਕੇ ਚਿੱਤਰਕਾਰੀ ਲਈ ਬਹੁਤ ਵਧੀਆ ਕੋਲਜ ਕੋਲਜ ਅਤੇ ਕੋਰਸ ਹਨ ਜਿਹਨਾਂ ਰਾਹੀਂ ਚਿੱਤਰਕਾਰੀ ਵਧੀਆ ਢੰਗ ਨਾਲ ਸਿੱਖੀ ਜਾ ਸਕਦੀ ਹੈ ਮੈਂ ਆਪਣੀ ਚਿੱਤਰਕਾਰੀ ਨੂੰ ਹੋਰ ਵਧੀਆ ਕਰਨ ਲਈ ਵਾਰ ਵਾਰ ਚਿੱਤਰਕਾਰ ਨੂੰ ਦੁਹਰਾਉਂਦੀ ਹਾਂ ਉਸਨੂੰ ਵਧੀਆ ਤਰੀਕੇ ਨਾਲ ਬਣਾਉਂਦੀ ਹਾਂ ਵਾਰ ਵਾਰ ਅਭਿਆਸ ਕਰਦੀ ਹਾਂ ਚਿੱਤਰਕਾਰੀ ਕਰਨ ਲਈ ਮੈਂ ਸੂਟ 'ਤੇ ਪੇਂਟ ਕਰਦੀ ਹਾਂ ਜਾਂ ਕਿਸੇ ਡਰਾਇੰਗ ਬੁੱਕ 'ਤੇ ਚਿੱਤਰਕਾਰੀ ਦੀ ਕਲਾ ਦਿਖਾਉਂਦੀ ਹਾਂ ਚਿੱਤਰਕਾਰੀ ਕਰਨ ਲਈ ਰੰਗਾਂ ਦੀ ਪਹਿਚਾਣ ਹੋਣਾ ਬਹੁਤ ਜ਼ਰੂਰੀ ਹੈ